ਭਾਰਤ ਵਿੱਚ ਸਿਹਤ ਪ੍ਰਣਾਲੀ ਬਹੁਤ ਹੀ ਵਧੀਆ ਹੈ ਅਤੇ ਭਾਰਤ ਵਿੱਚ ਥਾਂ ਥਾਂ 'ਤੇ ਸਿਹਤ ਕੇਂਦਰ ਸਿਹਤ ਕੇਂਦਰ ਅਤੇ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ ਇਸ ਤੋਂ ਇਲਾਵਾ ਸਿਵਲ ਹਸਪਤਾਲ ਵੀ ਖੋਲ੍ਹੇ ਗਏ ਇਸ ਵਿੱਚ ਸਾਨੂੰ ਮੁਫ਼ਤ ਦਵਾਈਆਂ ਮਿਲਦੀਆਂ ਹਨ ਅਤੇ ਘੱਟ ਰੇਟਾਂ 'ਤੇ ਅਸੀਂ ਮੁਫ਼ਤ ਇਲਾਜ ਕਰਵਾ ਸਕਦੇ ਹਾਂ ਅਤੇ ਹਸਪ ਹਸਪਤਾਲਾਂ ਵਿੱਚ ਪਿੰਡਾਂ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਆਪਣੀਆਂ ਬਿਮਾ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਡਾਕ ਡਾਕਟਰ ਕੋਲ਼ ਆਉਂਦੇ ਹਨ ਤਾਂ ਜੋ ਉਹ ਉਨ੍ਹਾਂ ਤਾਂ ਜੋ ਉਨ੍ਹਾਂ ਦੀ ਬਿਮਾਰੀ ਨੂੰ ਸਹੀ ਢੰਗ ਨਾਲ ਠੀਕ ਕੀਤਾ ਜਾ ਸਕੇ ਅਤੇ ਹੋਸਪੀਟਲ ਵਿੱਚ ਮਾਹਿਰ ਡਾਕਟਰ ਹੁੰਦੇ ਹਨ ਅਸੀਂ ਅਸੀਂ ਇਹਨਾਂ ਮਾਹਿਰ ਡਾਕਟਰਾਂ ਤੋਂ ਅਤੇ ਆਪਣੇ ਸਿਹਤ ਸੰਬੰਧੀ ਸਲਾਹ ਲੈ ਸਕਦੇ ਹਾਂ ਅਤੇ ਆਪਣਾ ਇਲਾਜ ਕਰਵਾ ਸਕਦੇ ਹਾਂ ਅਤੇ ਹਸਪਤਾਲ ਵਿੱਚ ਪੰ ਗਰੀਬ ਪਰਿਵਾਰਾਂ ਲਈ ਪੰਜ ਲੱਖ ਦਾ ਕਾਰਡ ਆਯੁਸ਼ਮਾਨ ਆਯੁਸ਼ਮਾਨ ਕਾਰਡ ਚਲਾਇਆ ਜਾਂਦਾ ਹੈ ਤਾਂ ਜੋ ਗਰੀਬ ਪਰਿਵਾਰ ਆਪਣਾ ਪੰਜ ਲੱਖ ਦਾ ਪੰਜ ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾ ਸਕੇ ਇਸ ਤੋਂ ਇਲਾਵਾ ਸੇਤ ਸੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਸਮੱਸ ਦੀਆਂ ਕਈ ਸਮੱਸਿਆਵਾਂ ਵੀ ਹਨ ਹੋਸ ਹਸਪਤਾਲਾਂ ਵਿਚ ਸਫ਼ਾਈਆਂ ਦੀ ਘਾਟ ਹਸਪਤਾਲਾਂ ਵਿੱਚ ਸਫ਼ਾਈਆਂ ਦੀ ਬਹੁਤ ਘਾਟ ਹੈ ਕਈ ਵਰਕਰ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਹਸਪਤਾਲਾਂ ਵਿੱਚ ਹਸਪਤਾਲਾਂ ਵਿੱਚ ਡਾਕਟਰਾਂ ਦੀ ਵੀ ਬਹੁਤ ਘਾਟ ਹੈ ਹਸਪਤਾਲ ਵਿੱਚ ਲੰਬ ਪੇਸ਼ੈਂਟ ਨੂੰ ਲੰਬੀਆਂ ਲਾਈਨਾਂ ਵਿਚ ਖੜ੍ਹਨਾ ਪੈਂਦਾ ਹੈ ਪਰਚੀਆਂ ਕਟਾਉਣ ਲਈ ਅਤੇ ਡਾਕਟਰ ਮਿਲਣ ਲਈ ਵੀ ਬਹੁਤ ਹੀ ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪ੍ਰ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਬਹੁਤ ਹੀ ਮਹਿੰਗਾ ਹੈ ਸਰਕਾਰੀ ਹੋਸਪੀਟਲ ਸਰਕਾਰੀ ਹੋਸਪੀਟਲ ਵਿੱਚ ਟੀਕਾਕਰਨ ਵੀ ਕੀਤਾ ਜਾਂਦਾ ਹੈ